ਹਾਂਜੀ ਨਮਸ਼ਕਾਰ ਮੈਡਮ ਮੈਮ ਕੁਛ ਪੁੱਛਣਾ ਮਨੋਵਿਗਿਆਨਿਕ ਮੁੱਦੇ 'ਤੇ ਮੈੜਮ ਮਤਲਬ ਮੈਂ ਜਦੋਂ ਵੀ ਕੋਈ ਕੰਮ ਕਰਦਾ ਤਾਂ ਮੈਨੂੰ ਮਤਲਬ ਸਕਸੈਸਫੁੱਲ ਹੋਇਆ ਸਫਲ ਹੁੰਦਾ ਨਹੀਂ ਹੁੰਦਾ ਮੈਨੂੰ ਇਸ ਟੌਪਿਕ 'ਤੇ ਬੜੀ ਚਿੰਤਾ ਰਹਿੰਦੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਰਾਤੀ ਹਾਂਜੀ

ਨਹੀਂ ਮੈਮ ਕੋਸ਼ਿਸ਼ ਕਰੀਏ ਤਾਂ ਵੀ ਆ ਜਾਂਦੀ ਹੈ ਇਸ ਬਾਰੇ ਅਸੀਂ ਮੈਂ ਬਹੁਤ ਸੋਚਿਆ ਕਿ ਇਸ ਬਾਰੇ ਨਾ ਸੋਚਿਆ ਕਰਾਂ ਪਰ ਫਿਰ ਵੀ ਇਹ ਚੀਜ਼ ਹੋ ਜਾਂਦੀ ਹੈ ਠੀਕ ਹੈ ਜੀ ਮੈਮ ਹੋਰ ਕਿਸ ਤਰ੍ਹਾਂ ਮਤਲਬ ਹੋਰ ਕੀ ਕੀ ਚੀਜ਼ਾਂ ਮੈਂ ਕਰਿਆ ਕਰਾਂ ਪੀ ਜਿਹਦੇ ਨਾਲ ਮੈਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਹਮ ਠੀਕ ਹੈ ਜੀ ਠੀਕ ਹੈ ਮੈਮ ਧੰਨਵਾਦ